ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਖੇਤੀ ਦੇ ਉਤਪਾਦਨ ਜਿਵੇਂਕਿ ਕੀ ਅਸੀਂ ਮੱਕੀ ਬੀਜਦੇ ਹਨ ਮੱਕੀ ਬੀਜਦੇ ਹਨ ਜੂਨ ਵਿੱਚ ਅਤੇ ਉਸਦੀ ਵਢਾਈ ਹੁੰਦੀ ਹੈ ਸਿਤੰਬਰ ਜਾਂ ਨਵੰਬਰ ਵਿੱਚ ਹੋਰ ਜਿੱਦਾਂ ਕਿ ਕ ਜਿੱਦਾਂ ਵੀ ਕਣਕ ਦੀ ਵਢਾਈ ਕਣਕ ਦੀ ਉਗਾਈ ਹੁੰਦੀ ਹੈ ਨਵੰਬ ਦਸ ਦ ਅਕਤੂਬਰ ਜਾਂ ਨਵੰਬਰ ਵਿੱਚ ਬਿਜਾਈ ਹੁੰਦੀ ਹੈ ਅਤੇ ਉਸ ਨੂੰ ਕਟਾਈ ਮਈ ਅਪ੍ਰੈਲ ਜਾਂ ਮਈ ਵਿੱਚ ਹੁੰਦੀ ਹਨ ਔਰ ਮ ਮੱਕੀ ਦੀ ਵੀ ਇੱਦਾਂ ਹੀ ਫਸਲ ਹੁੰਦੀ ਹੈ ਔਰ ਝੋਨਾ ਵੀ ਲਗਾਉਂਦੇ ਹਨ ਜੂਨ ਵਿੱਚ ਅਤੇ ਉਸ ਦੀ ਕਟਾਈ ਵੀ ਅ ਅਕਤੂਬਰ ਜਾਂ ਨਵੰਬਰ ਵਿੱਚ ਹੁੰਦੀ ਹਨ ਔਰ ਸਾਰੇ ਖੇਤੀ ਨਾਲ ਸਬੰਧ ਰੁਜ਼ਗਾਰ ਵਧਾਇਆ ਜਾਂਦਾ ਹਨ ਕਈ ਤਰ੍ਹਾਂ ਦੀਆਂ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ ਅਤੇ ਔਰ ਉਸ ਨੂੰ ਉਸ ਦੇ ਕਈ ਫਾਇਦੇ ਹੋ ਜਾਂਦੇ ਹਨ ਜੈਸੇ ਕਿ ਅਸੀਂ ਪ ਪਸ਼ੂ ਵੀ ਰੱਖਦੇ ਹਨ ਅਤੇ ਉਸ ਨਾਲ ਵੀ ਸਾਡਾ ਰੁਜ਼ਗਾਰ ਵਧਦਾ ਹਨ ਔਰ ਸਾਰੇ ਬਹੁਤ ਸਾਰੇ ਇੱਦਾਂ ਦੇ ਇੱਦਾਂ ਦੀ ਖੇਤੀ ਹਨ ਜਿਹਦੇ ਨਾਲ ਅਸੀਂ ਜਿੱਦਾਂ ਪਿਆਜ਼ ਵਗੈਰਾ ਵੀ ਲਾ ਸਕਦੇ ਹਨ